ਹਾਂਜੀ ਮੈਡਮ ਜੀ ਹਾਂਜੀ ਹਾਂਜੀ ਤੁਹਾਡਾ ਨੰਬਰ ਹੈਗਾ ਜੀ ਉਹ ਅੱਜ ਸਵੇਰੇ ਸਿਲਿੰਡਰ ਲੈ ਕੇ ਗਏ ਸੀ ਤਾਂ ਸਾਡੇ ਹੈਗਾ ਜੀ ਸੇਵ ਕੀਤਾ ਹੋਇਆ ਤੁਹਾਡਾ ਨੰਬਰ ਜੀ ਹਾਂਜੀ ਹਾਂਜੀ ਉਹ ਸੀ ਘਰ ਦੂਜੇ ਬੰਦੇ ਉਹਨਾਂ ਨੂੰ ਅਸੀਂ ਸਾਰਾ ਸਾਈਨ ਉਹਨਾਂ ਨੇ ਕੀਤੇ ਸੀ ਨਹੀਂ ਨਹੀਂ ਜੀ ਵੇਟ ਤਾਂ ਪੂਰਾ ਹੁੰਦਾ ਸਲੰਡਰਾਂ ਦੇ ਵਿੱਚ ਪਿੱਛੋਂ ਹੀ ਆਉਂਦੇ ਆ ਭਰ ਕੇ ਕੰਪਨੀ ਦੇ ਵੱਲੋਂ ਇਹਦੇ ਵਿੱਚ ਤਾਂ ਕੋਈ ਬਦਲਾਵ ਹੁੰਦਾ ਨਹੀਂ ਉਹ ਪਿੱਛੋਂ ਹੀ ਆਉਂਦੇ ਆ ਸਾਰੇ ਪਤਾ ਨਹੀਂ ਜੀ ਫਿਰ ਵੇਟ ਤਾਂ ਪੂਰਾ ਹੁੰਦਾ ਅਤੇ ਮੈਂ ਤੁਹਾਨੂੰ ਹੈਗਾ ਵਹਿਮ ਤਾਂ ਕੱਲ੍ਹ ਦੁਬਾਰਾ ਆ ਜਾਂਗੇ ਜੀ ਉਹਦਾ ਵੇਟ ਦੁਬਾਰਾ ਕਰਕੇ ਦੇ ਦਿਆਂਗੇ ਪਿਛਲੇ ਸਿਲਿੰਡਰ ਦਾ ਤਾਂ ਹੁਣ ਕੁਝ ਅਸੀਂ ਆਖ ਨਹੀਂ ਸਕਦੇ ਵੇਟ ਹੋਵੇ ਪਿੱਛੋਂ ਜਦੋਂ ਆਉਂਦੇ ਆ ਸਾਡੇ ਕੋਲ ਅਸੀਂ ਵੇਟ ਪੂਰੇ ਚੈੱਕ ਕਰਦੇ ਹਾਂ ਪਹਿਲਾਂ ਤਾਂ ਜਦੋਂ ਘਰ ਦਿੰਦੇ ਹਾਂ ਅਸੀਂ ਸਵੇਰੇ ਗੱਡੀ ਦੇ ਵਿੱਚ ਲੋਡ ਕਰਦੇ ਹਾਂ ਤਾਂ ਪੂਰਾ ਵੇਟ ਕਰਕੇ ਇੱਕ ਸਿੰਗਲ ਸਿੰਗਲ ਸਲੈਂਡਰ ਦਾ ਅਤੇ ਸਾਰੇ ਸਿਲੰਡਰ ਨੂੰ ਅਸੀਂ ਤੁਹਾਡੇ ਘਰ ਦੇ ਜਦੋਂ ਬਾਹਰ ਦਿੰਦੇ ਉਦੋਂ ਵੀ ਅਸੀਂ ਪ੍ਰੋਪਰ ਚੈੱਕ ਕਰਦੇ ਹਾਂ ਕਿ ਵੇਟ ਪੂਰਾ ਕਿ ਨਹੀਂ ਹੈ ਅਤੇ ਵੇਟ ਤਾਂ ਪੂਰਾ ਸੀ ਜੀ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਜੀ ਅਸੀਂ ਸਵੇਰੇ ਆ ਜਾਂਗੇ ਜੀ ਤੁਸੀਂ ਸਾਨੂੰ ਸਵੇਰ ਤੱਕ ਦਾ ਟਾਈਮ ਦਿਓ ਅਸੀਂ ਦੁਬਾਰਾ ਉਹਨੂੰ ਵੇਟ ਕਰ ਦਿਆਂਗੇ ਅਤੇ ਟਾਈਮ ਦੱਸ ਦਿਓ ਜਿੰਨੇ ਵਜੇ ਤੁਸੀਂ ਘਰ ਹੋਗੇ ਉਨੇ ਵਜੇ ਆ ਜਾਂਗੇ ਜੇ ਸਵੇਰੇ ਹੈਗੇ ਹੋ ਨਹੀਂ ਤਾਂ ਸ਼ਾਮ ਨੂੰ ਆ ਜਾਂਗੇ ਹਾਂਜੀ ਸ਼ਾਮ ਨੂੰ ਕਿੰਨੇ ਵਜੇ ਆਈਏ ਜੀ ਹਾਂਜੀ ਠੀਕ ਹੈ ਅਸੀਂ ਫਿਰ ਪੰਜ ਸਾਢੇ ਪੰਜ ਦੇ ਵਿੱਚ ਆਵਾਂਗੇ ਜੀ ਅਤੇ ਉਹਦਾ ਵੇਟ ਕਰ ਦਿਆਂਗੇ ਤੁਹਾਡੇ ਸਾਹਮਣੇ ਅਤੇ ਕੋਈ ਦਿੱਕਤ ਨਹੀਂ ਜੇ ਕੋਈ ਹੋਰ ਪਰੇਸ਼ਾਨੀ ਹੈਗੀ ਉਹ ਵੀ ਦੱਸ ਦਿਓ ਉਹ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਕੰਪਨੀ ਦੇ ਜਿਵੇਂ ਗਾਈਡਲਾਈਨ ਹੈਗੀਆਂ ਨੇ ਅਸੀਂ ਤੁਹਾਡੇ ਲਈ ਸਾਰਾ ਸਹਿਯੋਗ ਕਰਾਂਗੇ ਜੀ ਜੇ ਦਿੱਕਤ ਹੋ ਗਈ ਤਾਂ ਅਸੀਂ ਤੁਹਾਡਾ ਸਲੰਡਰ ਵੀ ਬਦਲ ਕੇ ਦੇ ਕੇ ਜਾਵਾਂਗੇ ਜੀ ਹਾਂਜੀ ਕੋਈ ਗੱਲ ਨਹੀਂ ਜੀ ਰੈਗੂਲੇਟਰ ਇੱਕ ਕੀ ਦਿੱਕਤ ਹੈ ਜੀ ਰੈਗੂਲੇਟਰ ਦੇ ਜੀ ਹਾਂਜੀ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਰੈਗੂਲੇਟਰ ਹੈ ਉਹ ਚੈੱਕ ਕਰ ਲਵਾਂਗੇ ਅਤੇ ਇੱਕ ਰੈਗੂਲੇਟਰ ਫਿਰ ਮੈਂ ਸਪੇਅਰ ਲਿਆਵਾਂ ਤੁਹਾਡੇ ਵਾਸਤੇ ਜੇ ਉਹਨੂੰ ਕੁਛ ਪੁਰਾਣੇ ਵਾਲੇ ਦਿੱਕਤ ਇੱਦਾਂ ਚੇਂਜ ਕਰ ਦਿਆਂਗੇ ਨਾਲ ਦੀ ਨਾਲ ਹੀ ਠੀਕ ਹੈ ਜੀ